ਮੈਂ ਅਤੇ ਮੇਰੇ ਯਾਰ ਦੋਸਤ ਮਸਤਾਨੇ ਮੂਵੀ ਦੇਖਣ ਗਏ ਸੀਗੇ ਥੀਏਟਰ ਦੇ ਵਿੱਚ ਬਹੁਤ ਸੰਗਤ ਸੀਗੀ ਜੋ ਕਿ ਮਸਤਾਨੇ ਫ਼ਿਲਮ ਨਾਮੀ ਮੂਵੀ ਰਿਲੀਜ਼ ਹੋਈ ਦੇਖਣ ਆਈ ਸੀਗੀ ਜਦੋਂ ਨਾਦਰ ਸ਼ਾਹ ਦਿੱਲੀ ਲੁੱਟ ਕੇ ਲਿਜਾ ਰਿਹਾ ਸੀਗਾ ਰਾਸਤੇ ਦੇ ਵਿੱਚ ਕਿਸ ਤਰ੍ਹਾਂ ਸਿੰਘਾਂ ਨੇ ਉਹਨੂੰ ਮਾਤ ਪਾਈ ਆਪਣੇ ਦਿੱਲੀ ਦੀਆਂ ਜਿੰਨੀਆਂ ਵੀ ਕੁੜੀਆਂ ਸੀਗੀਆਂ ਉਹਨਾਂ ਕੋਲੋਂ ਨਾਦਰ ਸ਼ਾਹ ਦੀ ਫੌਜ ਕੋਲੋਂ ਛੁਡਾਈਆਂ ਆਪੋ ਆਪਣੇ ਘਰਾਂ ਭੇਜੀਆਂ ਸਿੰਘਾਂ ਦੀਆਂ ਡਿਊਟੀਆਂ ਲਾ ਕੇ ਉਹ ਸਾਰਾ ਫਿਲਮ ਦੇ ਵਿੱਚ ਬਿਆਨ ਕੀਤਾ ਗਿਆ ਔਰ ਕਿਸ ਤਰ੍ਹਾਂ ਸਿੰਘ ਜੰਗਲਾਂ ਦੇ ਵਿੱਚ ਭੁੱਖਣ ਭਾਣੇ ਰਹਿੰਦੇ ਸੀਗੇ ਸਾਡਾ ਪੁਰਾਤਨ ਇਤਿਹਾਸ ਸਾਡੇ ਪੁਰਖਿਆਂ ਦਾ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੋਂ ਪਹਿਲਾਂ ਦਾ ਰਾਜ ਜੋ ਕਿ ਉਸ ਫ਼ਿਲਮ ਦੇ ਵਿੱਚ ਦਰਸਾਇਆ ਗਿਆ ਦਿਖਾਇਆ ਗਿਆ ਇਸ ਕਰਕੇ ਸਾਨੂੰ ਬੜਾ ਫ਼ਕਰ ਮਹਿਸੂਸ ਹੋਇਆ ਵੀ ਅਸੀਂ ਪੰਜਾਬ ਦੀ ਧਰਤੀ 'ਤੇ ਜਨਮ ਲਿਆ ਅਸੀਂ ਖੁਦ ਸਿੱਖੀ ਸਰੂਪ ਦੇ ਵਿੱਚ ਸਾਰੇ ਨੌਜਵਾਨ ਫ਼ਿਲਮ ਦੇਖਣ ਗਏ ਸਾਨੂੰ ਹੁਣ ਤੱਕ ਦੀ ਸਭ ਤੋਂ ਵਧੀਆ ਦਿਲਚਸਪ ਗੱਲ ਤਾਂ ਇਹੀ ਲੱਗਦੀ ਹੈ ਵੀ ਅਸੀਂ ਸਿੱਖ ਹਾਂ